ਭੰਗੜਾ ਪੰਜਾਬ ਦਾ ਲੋਕ ਨਾਚ ਹੈ ਭੰਗੜਾ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦਾ ਹੈ ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸੀ ਤਾਂ ਮੈਂ ਵੀ ਭੰਗੜੇ ਵਿੱਚ ਪਾਰਟੀਸਪੇਟ ਕਰਦਾ ਸੀ ਅਤੇ ਭੰਗੜਾ ਮੇਰੀ ਹੋਬੀ ਹੈ ਮੈਂ ਆਪਣੀ ਹੋਬੀ ਨੂੰ ਕਾਲਜ ਵਿੱਚ ਬਰਕਰਾਰ ਰੱਖਿਆ ਇਹ ਪੰਜਾਬੀ ਸੱਭਿਆਚਾਰ ਦੇ ਜ਼ੋਰਦਾਰ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਅਹਿਮ ਯੋਗਦਾਨ ਪ੍ਰਦਾਨ ਕਰਦੇ ਹਨ ਇਹ ਭੰਗੜੇ ਨੂੰ ਹੋਰ ਰੋਮਾਂਚਕ ਬਣਾ ਦਿੰਦੇ ਹਨ ਜਿਸ ਨਾਲ ਆਸੇ ਪਾਸੇ ਦਾ ਮਾਹੌਲ ਜਸ਼ਨਮਈ ਬਣ ਜਾਂਦਾ ਹੈ ਭੰਗੜਾ ਐਰੋਬਿਕਸ ਇੱਕ ਤਰ੍ਹਾਂ ਦੀ ਐਕਸਰਸਾਈਜ ਹੈ ਭੰਗੜਾ ਪਉਣ ਨਾਲ ਸਾਡਾ ਸਰੀਰ ਆਪ ਹੀ ਜੋਸ਼ ਵਿੱਚ ਆ ਜਾਂਦਾ ਹੈ ਭੰਗੜਾ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦਾ ਹੈ ਕਣਕ ਪੱਕਣ ਦੀ ਖੁਸ਼ੀ ਵਿੱਚ ਕਿਸਾਨਾਂ ਵੱਲੋਂ ਪਾਇਆ ਜਾਂਦਾ ਹੈ ਭੰਗੜਾ ਮੁੰਡੇ ਅਤੇ ਕੁੜੀਆਂ ਦੋਨਾਂ ਦੁਆਰਾ ਪਾਇਆ ਜਾਂਦਾ ਹੈ ਭੰਗੜਾ ਪਾਉਂਦੇ ਸਮੇਂ ਸੱਭਿਆਚਾਰਕ ਪਹਿਰਾਵਾ ਪਾਇਆ ਜਾਂਦਾ ਹੈ ਮੁੰਡਿਆਂ ਵੱਲੋਂ ਕੁੜਤਾ ਚਾਦਰਾ ਅਤੇ ਕੁੜੀਆਂ ਵੱਲੋਂ ਕੁੜਤਾ ਧੋਤੀ ਪਾਈ ਜਾਂਦੀ ਹੈ